ਸਤਿ ਸ਼੍ਰੀ ਅਕਾਲ ਜੀ ਤੁਸੀਂ ਉਬਰਸ ਟੈਕਸੀ ਸਟੈਂਡ ਤੋਂ ਬੋਲਦੇ ਹੋ ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੀ ਸੀ ਕਿ ਮੈਂ ਖਰੜ ਤੋਂ ਅੰਮ੍ਰਿਤਸਰ ਸਾਹਿਬ ਜਾਣਾ ਹੈ ਅਤੇ ਉੱਥੇ ਮੈਂ ਅਤੇ ਕਈ ਥਾਵਾਂ 'ਤੇ ਅਸੀਂ ਰੁਕਣਾ ਵੀ ਹੈ ਰਸਤੇ 'ਚ ਜਾਂਦੇ ਜਾਂਦੇ ਅਤੇ ਕਈ ਥਾਵਾਂ ਅਸੀਂ ਦੇਖਣੀਆਂ ਵੀ ਨੇ ਅਤੇ ਮੈਂ ਇਹੀ ਜਾਣਕਾਰੀ ਲੈਣਾ ਚਾਹੁੰਦੀ ਸੀ ਕਿ ਤੁਸੀਂ ਆਪਣੀ ਪੇਮੈਂਟ ਕਿਵੇਂ ਲਉਂਗੇ ਜਾਂਦੇ ਹੋਏ ਔਨਲਾਈਨ ਜਾਂ ਕੈਸ਼ ਅਤੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਸਾਡੀ ਫੈਮਿਲੀ ਦੇ ਵਿੱਚ ਸੱਤ ਮੈਂਬਰ ਹੋਣਗੇ ਜਿਨ੍ਹਾਂ ਨੇ ਅਸੀਂ ਜਾਣਾ ਹੈ ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਕਿ ਰਸਤੇ ਵਿੱਚ ਅਸੀਂ ਕਈ ਥਾਵਾਂ 'ਤੇ ਰੁਕਣਾ ਵੀ ਹੈ ਅਤੇ ਉਹ ਮੈਂ ਤੁਹਾਨੂੰ ਥਾਵਾਂ ਦੱਸ ਦਿੰਦੀ ਹਾਂ ਖੜਕਲ ਖਟਕੜ ਕਲਾਂ ਭਗਤ ਸਿੰਘ ਦਾ ਜੱਦੀ ਪਿੰਡ ਉਹ ਦੇਖਣਾ ਹੈ ਅਤੇ ਉਸ ਤੋਂ ਬਾਅਦ ਕਪੂਰਥਲਾ ਸਾਇੰਸ ਸਿਟੀ ਫਿਰ ਉਸ ਤੋਂ ਬਾਅਦ ਹਵੇਲੀ ਹਵੇਲੀ ਦੇ ਵਿੱਚ ਜਿੱਦਾਂ ਅਸੀਂ ਲੰਚ ਵੀ ਕਰ ਸ ਲੰਚ ਕਰਨਾ ਅਤੇ ਪਿੰਡ ਦਾ ਵਿਰਸਾ ਵੀ ਦੇਖਣਾ ਹੈ ਕਾਫੀ ਕੁਛ ਹੈਗਾ ਉੱਥੇ ਦੇਖਣ ਵਾਸਤੇ ਵੀ ਅਤੇ ਉਸ ਤੋਂ ਬਾਅਦ ਅਸੀਂ ਜਾਣਾ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਜਾਣ ਦਰਸ਼ਨ ਕਰਨ ਤੋਂ ਬਾਅਦ ਦੋ ਘੰਟੇ ਅਤੇ ਉਸ ਤੋਂ ਬਾਅਦ ਅਸੀਂ ਜਲ੍ਹਿਆਂਵਾਲਾ ਬਾਗ ਦੇਖਣਾ ਜਲ੍ਹਿਆਂਵਾਲਾ ਬਾਗ ਦੇਖਣ ਤੋਂ ਬਾਅਦ ਅਸੀਂ ਉੱਥੇ ਇੱਕ ਨਾਈਟ ਸਟੇਅ ਕਰਾਂਗੇ ਨਾਈਟ ਸਟੇਅ ਕਰਨ ਤੋਂ ਬਾਅਦ ਅਸੀਂ ਅਗਲੇ ਦਿਨ ਜਾਵਾਂਗੇ ਬ ਬਾਘਾ ਬੋਡਰ ਬਾਘਾ ਬੋਡਰ ਤੋਂ ਬਾਅਦ ਦੁਰਗਿਆਨਾ ਮੰਦਰ ਦੁਰਗਿਆਨਾ ਮੰਦਰ ਦੇ ਵਿੱਚ ਅਸੀਂ ਮਾਤਾ ਦੇ ਦਰਸ਼ਨ ਕਰਨੇ ਆ ਅਤੇ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਜਾਵਾਂਗੇ ਬਾਬਾ ਦੀਪ ਸਿੰਘ ਜੀ ਦੇ ਜਿੱਥੇ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ ਸੀ ਉਹ ਦੇਖਣਾ ਹੈ ਅਤੇ ਮੈਂ ਅਤੇ ਉਸ ਤੋਂ ਬਾਅਦ ਅਸੀਂ ਖਰੜ ਵਾਪਸ ਆਵਾਂਗੇ ਅਤੇ ਤੁਸੀਂ ਆਪਣਾ ਪੇਮੈਂਟ ਦਾ ਜੋ ਵੀ ਪ੍ਰੋਸੈਸ ਹੈਗਾ ਉਹ ਤੁਸੀਂ ਉਹ ਸਾਨੂੰ ਦੱਸ ਸਕਦੇ ਹੋ ਕਿੰਨਾ ਸਮਾਂ ਲੱਗੂਗਾ ਕਿੰਨੀ ਤੁਸੀਂ ਪੇਮੈਂਟ ਲਉਂਗੇ ਅਤੇ ਟੋਲ ਟੈਕਸ ਵਗੈਰਾ ਵੀ ਤੁਸੀਂ ਆਪ ਖੁਦ ਦੇ ਸਕਦੇ ਹੋ ਅਤੇ ਅਸੀਂ ਉਸ ਤੋਂ ਬਾਅਦ ਹੀ ਆਪਣੀ ਸਾਰੀ ਪੇਮੈਂਟ ਤੁਹਾਨੂੰ ਕਰ ਦੇਵਾਂਗੇ ਅਤੇ ਧੰਨਵਾਦ